ਮੇਰੀ ਮਨਪਸੰਦ ਕਿਤਾਬ ਜਿਹੜੀ ਅੰਗਰੇਜ਼ੀ ਦੀ ਮਰਚੰਟ ਔਫ ਵੈਨਿਸ ਹੈ ਇਹ ਇੱਕ ਬਹੁਤ ਹੀ ਵਧੀਆ ਡਰਾਮਾ ਹੈ ਅੰਗਰੇਜ਼ੀ ਦਾ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖਿਆ ਹੋਇਆ ਮੈਂ ਇਸਨੂੰ ਬਹੁਤ ਵਾਰ ਪੜ੍ਹ ਚੁੱਕਾ ਹਾਂ ਘੱਟੋ ਘੱਟ ਚਾਲੀ ਤੋਂ ਪੰਜਾਹ ਵਾਰ ਮੈਨੂੰ ਬਹੁਤ ਅੱਛੀ ਲੱਗਦੀ ਹੈ ਮੈਂ ਇਸ ਨੂੰ ਵਾਰ ਵਾਰ ਪੜ੍ਹਦਾ ਹਾਂ ਕਾਰਨ ਉਹਦੇ ਵਿੱਚ ਯਹੂਦੀਆਂ ਅਤੇ ਇਸਾਈਆਂ ਦੇ ਬਾਰੇ ਕਹਾਣੀ ਹੈ ਜਿਹਦੇ ਵਿੱਚ ਕਿ ਕੰਟੋਨੀਓ ਹੁੰਦਾ ਹੈ ਬਹੁਤ ਹੀ ਅਮੀਰ ਵਪਾਰੀ ਹੁੰਦਾ ਹੈ ਪਰ ਉਹਦਾ ਪਰਿਵਾਰ ਨਹੀਂ ਹੁੰਦਾ ਉਹਦਾ ਦੋਸਤ ਪੈਸੈਨੀਓ ਹੁੰਦਾ ਹੈ ਜੋ ਕਿ ਬਹੁਤ ਹੀ ਰੋਇਲ ਫੈਮਲੀ ਵਾਂਗੂ ਆਪਣੇ ਸਟੈਂਡਰਡਜ਼ ਮੈਟੇਨ ਕਰਦਾ ਹੈ ਪਰ ਪੈਸਾ ਉਹਦੇ ਪੱਲੇ ਨੀ ਉਹ ਐਨਟੋਨੀਓ ਤੋਂ ਉਧਾਰ ਲੈਂਦਾ ਹੈ ਐਨਟੋਨੀਓ ਉਹਦੀ ਹਰ ਤਰ੍ਹਾਂ ਮਦਦ ਕਰਦਾ ਹੈ ਐਨਟੋਨੀਓ ਉਹਦੇ ਲਈ ਦੋ ਹਜ਼ਾਰ ਤਿੰਨ ਹਜ਼ਾਰ ਡੁਕੈਤ ਉਧਾਰ ਲੈਂਦਾ ਹੈ ਸਾਈਲਕ ਨਾਮਕ ਯਹੂਦੀ ਤੋਂ ਜਿਹੜਾ ਕਿ ਪੈਸਿਆਂ ਨੂੰ ਉਧਾਰ ਦੇ ਕੇ ਅਤੇ ਉਹ 'ਤੇ ਕਰਜ਼ਾ ਵਸੂਲਦਾ ਹੈ ਸੋ ਉਹ ਆ ਬੈਲਮਾਉਂਟ ਜਾਂਦਾ ਹੈ ਪਸੈਨੀਓ ਜਿਹੜਾ ਹੁੰਦਾ ਹੈ ਅਤੇ ਆਪਣੀ ਫਾਈਂਸੀ ਪੋਸ਼ੀਆ ਦੇ ਨਾਲ ਵਿਆਹ ਕਰਨ ਦੇ ਲਈ ਉਹ ਉੱਥੇ ਫਾਈਨਲੀ ਪਹੁੰਚਦਾ ਹੈ ਬਾਕੀ ਸਾਰਿਆਂ ਨੂੰ ਪੋਸ਼ੀਆ ਨਕਾਰ ਦਿੰਦੀ ਹੈ ਉਹ ਵੀ ਅਜੀਬ ਹੀ ਤਰ੍ਹਾਂ ਦੀ ਹੁੰਦੀ ਹੈ ਤਿੰਨ ਕਾਸਕਿਟਸ ਹੁੰਦੀਆਂ ਨੇ ਸੋਨੇ ਚਾਂਦੀ ਅਤੇ ਲੈਡ ਦੀ ਅਤੇ ਉਹਦੇ ਵਿੱਚ ਉਹਦਾ ਫੋਟੋ ਰੱਖੀ ਹੁੰਦੀ ਹੈ ਜਿਹੜਾ ਸਹੀ ਕਾਸਕਟ ਚੂਜ ਕਰੇਗਾ ਉਹਦੇ ਨਾਲ ਉਹਦਾ ਵਿਆਹ ਕੀਤਾ ਜਾਏਗਾ ਸੋ ਫਾਈਨਲੀ ਅ ਜਿਹੜਾ ਬਸੈਨੀਓ ਹੁੰਦਾ ਹੈ ਉਹ ਅ ਜਿਹੜਾ ਲੈਡ ਦੀ ਕਾਸਕਿਟ ਚੂਜ ਕਰਦਾ ਹੈ ਅਤੇ ਉਹਦੇ ਵਿੱਚੋਂ ਪੋਰਸ਼ੀਆ ਦਾ ਪੋਰਟਰੇਟ ਨਿਕਲਦਾ ਹੈ ਅਤੇ ਉਹਨਾਂ ਦੋਵਾਂ ਦਾ ਫਿਰ ਵਿਆਹ ਹੁੰਦਾ ਪਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ ਇੱਥੇ ਟਵਿਸਟ ਆਉਂਦਾ ਹੈ ਕੀ ਹੁੰਦਾ ਹੈ ਕਿਦ ਜਿਹੜਾ ਟਾਈਮ ਹੁੰਦਾ ਉਹਨਾਂ ਲਿਆਉਣ ਦਾ ਤਿੰਨ ਮਹੀਨੇ ਦਾ ਉਹ ਬੀਤ ਚੁੱਕਾ ਹੁੰਦਾ ਅਤੇ ਅੰਟੋਨੂਓ ਦੇ ਜਹਾਜ਼ ਜਿਹੜੇ ਉਹ ਸਾਰੇ ਡੁੱਬ ਜਾਂਦੇ ਨੇ ਫਿਰ ਅੰਟੋਨੀਓ ਨੂੰ ਜੇਲ੍ਹ 'ਚ ਕੈਦ ਕੀਤਾ ਜਾਂਦਾ ਉਹ 'ਤੇ ਕੇਸ ਪੈ ਜਾਂਦਾ ਫਿਰ ਪੋਰਸ਼ੀਆ ਜਿਹੜੀ ਹੈ ਭੇਸ ਬਦਲ ਕੇ ਆਉਂਦੀ ਹੈ ਉਹਦੀ ਕੇਸ ਦੀ ਹੇਰਿੰਗ ਕਰਦੀ ਹੈ ਇਹ ਦੱਸਿਆ ਗਿਆ ਕਿ ਉਹ ਬਿਲਕੁਲ ਕੋੜੀ ਕੋਰੀ ਅਨਪੜ੍ਹ ਹੈ ਲੇਕਿਨ ਕੇਸ ਦੇ ਵਿੱਚ ਉਹ ਅਜਿਹੀਆਂ ਅਜਿਹੀਆਂ ਦਲੀਲਾਂ ਦਿੰਦੀ ਹੈ ਅਤੇ ਕਹਾਣੀ ਨੂੰ ਫਿਰ ਮੋੜ ਦਿੰਦੀ ਹੈ ਇੱਕ ਵਾਰ ਇੱਧਰਲੇ ਪਾਸੇ ਅਤੇ ਅੰਟੋਨੀਓ ਨੂੰ ਬਚਾ ਲੈਂਦੀ ਹੈ ਸ਼ਾਇਲਬ ਜਿਹੜਾ ਯਹੂਦੀ ਹੁੰਦਾ ਉਹਨੇ ਇਹ ਸ਼ਰਤ ਰੱਖੀ ਹੁੰਦੀ ਆ ਕਿ ਅਗਰ ਉਹ ਰਹਿੰਦੇ ਸਮੇਂ ਤੱਕ ਪੈ ਪੈਸੇ ਨਾ ਵਾਪਸ ਕਰ ਸਕਿਆ ਤਾਂ ਉਹ ਕੀ ਕਰੇਗੀ ਉਹ ਕੀ ਕਰੇਗਾ ਕੀ ਉਹਦਾ ਪਾਉਂਡ ਔਫ ਫਲੈਸ਼ ਲਏਗਾ ਉਹ ਵੀ ਨਿਰਬਾਏ ਹਾਰਟ ਸੋ ਬੜੀ ਦਿੱਕਤ ਹੋ ਜਾਂਦੀ ਹੈ ਸਭ ਨੂੰ ਇਹ ਲੱਗਦਾ ਕਿ ਉਹ ਮਾਰਿਆ ਜਾਵੇਗਾ ਇੰਟੋਨੀਓ ਪਰ ਪੋਰਸੀਆ ਉਹਨੂੰ ਬਚਾ ਲੈਂਦੀ ਹੈ ਕਿ ਕੋਰਟ ਦੇ ਜਿਹੜਾ ਬਾਉਂਡ ਸਾਈਨ ਕੀਤਾ ਉਹਦੇ ਵਿੱਚ ਇਹ ਲਿਖਿਆ ਸੀ ਕਿ ਉਹ ਸਿਰਫ ਪਾਉਂਡ ਔਫ ਫਲੈਸ ਲੈ ਸਕਦਾ ਖੂਨ ਨਹੀਂ ਲੈ ਸਕਦਾ ਅਤੇ ਜੇਕਰ ਇੱਕ ਡਰੋਪ ਵੀ ਖੂਨ ਦਾ ਡਿੱਗਾ ਤਾਂ ਉਹਦੀ ਸਾਰੀ ਪ੍ਰੋਪਰਟੀ ਜਬਤ ਕਰ ਲਈ ਜਾਏਗੀ ਅਤੇ ਉਹਨੂੰ ਵੀ ਸਜ਼ਾ ਹੋ ਜਾਏਗੀ ਉਹ ਨਿਰਾਸ਼ ਹੋ ਕੇ ਵਾਪਸ ਚਲਾ ਜਾਂਦਾ ਅਤੇ ਫਿਰ ਉਹਨੂੰ ਮਜਬੂਰਨ ਇਸਾਈ ਧਰਮ ਵੀ ਕਬੂਲਣਾ ਪੈਂਦਾ ਹੈ ਧੰਨਵਾਦ